ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਕੀ ਤੁਸੀਂ ਬੀਜਪੁਰਾਗ ਤੋਂ ਬੋਲਦੇ ਹੋ ਹਾਂਜੀ ਅਸੀਂ ਤੁਹਾਨੂੰ ਜੀ ਬੀਜਾਂ ਬਾਰੇ ਪੁੱਛਣਾ ਸੀਗਾ ਵੀ ਕਿਹੜੇ ਕਿਹੜੇ ਬੀਜ ਤੁਹਾਡੇ ਕੋਲ ਹੈਗੇ ਆ ਅਤੇ ਕੀ ਰੇਟ ਆ ਉਹਨਾਂ ਦਾ ਜੋ ਵੀ ਪ੍ਰੋਸੈਸ ਹੈਗਾ ਤੁਸੀਂ ਉਹ ਮੈਨੂੰ ਦੱਸ ਦਿਓ ਕਿਹੜੇ ਕਿਹੜੇ ਹੈ ਜੀ ਹਾਂਜੀ ਹਾਂਜੀ ਮਤਲਬ ਸਾਰੇ ਹੀ ਮਿਲ ਜਾਣਗੇ ਤੁਹਾਡੇ ਕੋਲ ਅਤੇ ਜੀ ਤੁਸੀਂ ਉਹਨਾਂ ਦਾ ਰੇਟ ਕੀ ਲਗਾਓਂਗੇ ਹਾਂਜੀ ਹਾਂਜੀ ਅਤੇ ਜੀ ਕਿੰਨੇ ਕੁ ਕਿੰਨੇ ਕੁ ਬੀਜ ਹੈਗੇ ਮਤਲਬ ਵੀ ਚਾਰ ਪੰਜ ਦਿਨਾਂ ਤੱਕ ਉਹ ਰਹਿ ਜਾਣਗੇ ਜਾਂ ਖ਼ਤਮ ਤਾਂ ਨਹੀਂ ਹੋ ਜਾਣਗੇ ਜੇ ਅਸੀਂ ਲੇਟ ਵੀ ਆਈਏ ਤਾਂ ਹਾਂਜੀ ਠੀਕ ਹੈ ਜੀ ਅਤੇ ਜੇ ਹੋਰ ਕੁਝ ਜੀ ਅਸੀਂ ਇੱਥੋਂ ਹੀ ਹੈ ਸਾਡਾ ਇਲਾਕਾ ਫਰੀਦਕੋਟ ਤੋਂ ਹੀ ਹੈ ਅਸੀਂ ਹਾਂਜੀ ਤਾਂ ਫਿਰ ਅਸੀਂ ਸੋਚ ਰਹੇ ਸੀਗੇ ਵੀ ਅੱਜ ਕੱਲ੍ਹ ਸਾਰੇ ਵੀ ਚੌਲ ਆ ਚੌਲ ਕਰਦੇ ਕਣਕ ਕਰਦੇ ਵੀ ਅਸੀਂ ਕੋਈ ਹੋਰ ਵੱਖਰੀ ਫ਼ਸਲ ਕਰੀਏ ਤਾਂ ਕਿ ਜੀ ਪਾਣੀ ਦੀ ਥੋੜ੍ਹੀ ਬਚਤ ਹੋ ਸਕੇ ਹਾਂਜੀ ਉਹੀ ਤਾਂ ਪਾਣੀ ਖ਼ਰਾਬ ਹੀ ਹੋਈ ਜਾਂਦਾ ਪਾਣੀ ਵੇਸਟ ਹੀ ਹੋਈ ਜਾਂਦਾ ਨਿਰਾ ਹੀ ਅਤੇ ਜੀ ਆਹ ਸੈਮੀਨਾਰ ਕਦੋਂ ਕਦੋਂ ਲੱਗਦੇ ਹੁੰਦੇ ਆ ਅੱਛਾ ਪੰਦਰਾਂ ਤਰੀਕ ਨੂੰ ਲੱਗਾ ਅਤੇ ਜੀ ਕਿੰਨੇ ਕੁ ਵਜੇ ਸ਼ੁਰੂ ਹੋਵੇਗਾ ਹਾਂਜੀ ਠੀਕ ਹੈ ਜੀ ਅਸੀਂ ਆ ਜਾਵਾਂਗੇ ਟਾਈਮ ਨਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ